ਹਾਂਜੀ ਮੇਰੀ ਮਨ ਪਤਾ ਪਸੰਦ ਕਿਤਾਬ ਅੰਮ੍ਰਿਤਾ ਪ੍ਰੀਤਮ ਦੀ ਲਿਖੀ ਹੋਈ ਹੈ ਜੋ ਕਿ ਇੱਕ ਕਵਿਤਾ ਹੈ ਵਾਰਸ ਸ਼ਾਹ ਅੰਮ੍ਰਿਤਾ ਪ੍ਰੀਤਮ ਦੀ ਲਿਖੀ ਹੋਈ ਜੋ ਕਿ ਮੈਨੂੰ ਬਹੁਤ ਪਸੰਦ ਹੈ ਕਵਿਤਾ ਅਤੇ ਮੈਂ ਚਾਹੁੰਦੀ ਹਾਂ ਕਿ ਇਸ ਕਵਿਤਾ ਕਿ ਕੋਈ ਫਿਲਮ ਆਵੇ ਅਤੇ ਮੈਂ ਦੇਖਾਂ ਇਹ ਕਿਤਾਬ ਮੈਂ ਬਹੁਤ ਵਾਰ ਪੜ੍ਹ ਚੁੱਕੀ ਹਾਂ ਜਿਸ ਵਿੱਚ ਉਹਨਾਂ ਦੀ ਲਿਖੀ ਹੋਈ ਕਵਿਤਾ ਵਾਰਸ਼ ਸ਼ਾਹ ਹੈ ਅੰਮ੍ਰਿਤਾ ਪ੍ਰੀਤਮ ਜੀ ਨੇ ਵਾਰਸ਼ ਸ਼ਾਹ ਨੂੰ ਕਹਿੰਦੇ ਹੋਏ ਦੁੱਖ ਪ੍ਰਗਟ ਕੀਤਾ ਹੈ ਉੱਨੀ ਸੌ ਸੰਤਾਲੀ ਦੀ ਵੰਡ ਦਾ ਜਿਸ ਵਿੱਚ ਅੰਮ੍ਰਿਤਾ ਪ੍ਰੀਤਮ ਜੀ ਵਾਰਸ਼ ਸ਼ਾਹ ਨੂੰ ਕਹਿੰਦੇ ਹਨ ਅੱਜ ਆਖਾਂ ਵਾਰਸ਼ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ਅਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਉਹ ਵਾਰਸ ਸ਼ਾਹ ਨੂੰ ਕਹਿੰਦੇ ਹਨ ਕਿ ਕਿਤਿਓ ਤਾਂ ਬੋਲੋ ਕਬਰਾਂ ਵਿੱਚੋਂ ਉੱਠ ਕੇ ਬੋਲੋ ਕਿਤਾਬ ਦੇ ਅਗਲੇ ਪੰਨੇ ਨੂੰ ਤਾਂ ਫੋਲੋ ਜਦੋਂ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲੱਖਾਂ ਲਿਖ ਲਿਖ ਮਾਰੇ ਵੈਣ ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਸ਼ ਸ਼ਾਹ ਨੂੰ ਕਹਿਣ ਅੰਮ੍ਰਿਤਾ ਪ੍ਰੀਤਮ ਜੀ ਵਾਰਸ਼ ਸ਼ਾਹ ਨੂੰ ਕਹਿੰਦੇ ਹਨ ਕਿ ਤੁਸੀਂ ਬੋਲੋ ਤਾਂ ਸਹੀ ਤੁਸੀਂ ਕਿਉਂ ਨਹੀਂ ਬੋਲਦੇ ਜਦੋਂ ਇੱਕ ਧੀ ਰੋਈ ਸੀ ਤਾਂ ਤੁਸੀਂ ਕਿੰਨੇ ਵੈਣ ਪਾਏ ਸੀ ਅਤੇ ਹੁਣ ਇੰਨੀਆਂ ਧੀਆਂ ਰੋਂਦੀਆਂ ਇੰਨਾ ਕੁਛ ਹੋ ਰਿਹਾ ਤੁਸੀਂ ਕਿਉਂ ਨਹੀਂ ਬੋਲਦੇ ਧੰਨਵਾਦ